ਸਾਡਾ ਹੇਮਕੁੰਟ ਸਾਹਿਬ ਜਾਣ ਦਾ ਪਲੈਨ ਕੁਝ ਦਿਨਾਂ ਪਹਿਲਾਂ ਹੀ ਬਣ ਗਿਆ ਸੀ ਉਹ ਜੂਨ ਦੇ ਮਹੀਨੇ ਅਸੀਂ ਜੂਨ ਦੇ ਮਹੀਨੇ ਵਿੱਚ ਜਾਣਾ ਸੀ ਉਹ ਗਰਮੀਆਂ ਵਿੱਚ ਹੀ ਖੁੱਲ੍ਹਾ ਖੋਲਿਆ ਜਾਂਦਾ ਹੈ ਕਿਉਂਕਿ ਉੱਥੇ ਠੰਡ ਬਹੁਤ ਹੁੰਦੀ ਹੈ ਅਤੇ ਉੱਥੇ ਮੈਨੂੰ ਜਾਣ ਜਾਣ ਦਾ ਕ ਅ ਡਰ ਲੱਗ ਰਿਹਾ ਸੀ ਕਿਉਂਕਿ ਉਹ ਉੱਥੇ ਠੰਡ ਵੀ ਅਤੇ ਉਚਾਈ ਵੀ ਬਹੁਤ ਸੀ ਅਤੇ ਮੈਂ ਜਦੋਂ ਅਸੀਂ ਪਹਿਲਾਂ ਕ ਅ ਕਸ਼ਮੀਰ ਵੱਲ ਗਏ ਅਤੇ ਉੱਥੇ ਤੋਂ ਅਸੀਂ ਹੇ ਅ ਕੁਝ ਦੇਰ ਬਾਅਦ ਹੇਮਕੁੰਟ ਸਾਹਿਬ ਪਹੁੰਚ ਗਏ ਅਤੇ ਉੱਥੇ ਮੱਥਾ ਟੇਕ ਕੇ ਮੈਨੂੰ ਬਹੁਤ ਵਧੀਆ ਲੱਗਿਆ ਉੱਥੇ ਪੰਜ ਨਿਸ਼ਾਨ ਸਾਹਿਬ ਸਿਰਜਣਾ ਕੀਤੀ ਹੋ ਸਿਰਜਣਾ ਕੀਤੀ ਹੋਈ ਹੈ ਅਤੇ ਉੱਥੇ ਬ ਉੱਥੇ ਬਹੁਤ ਮਨ ਨੂੰ ਸਕੂਨ ਮਿਲਦਾ ਹੈ ਜਾ ਕੇ ਅਤੇ ਉੱਥੇ ਬਹੁਤ ਵਧੀਆ ਹੈ ਅਤੇ ਲੰਗਰ ਹਾਲ ਵੀ ਬਹੁਤ ਵੱਡਾ ਹੈ ਅਤੇ ਉੱਥੇ ਬਹੁਤ ਅਤੇ ਉੱਥੇ ਜਾਣਾ ਮੈਨੂੰ ਬਹੁਤ ਵਧੀਆ ਲੱਗਿਆ